ਮੈਂ ਤੁਹਾਡੀ ਏਜੰਸੀ ਤੋਂ ਗੈਸ ਸਟੋਵ ਦੀ ਬੁਕਿੰਗ ਕਰਾਉਣਾ ਚਾਹੁੰਦੀ ਹਾਂ ਮੇਰੇ ਗੈਸ ਸਟੋਵ ਖਪਤਕਾਰ ਆਈਡੀ ਦਾ ਨੰਬਰ ਹੈ ਛੇ ਸੱਤ ਅੱਠ ਨੌ ਗਿਆਰ੍ਹਾਂ ਪੰਦਰ੍ਹਾਂ ਅਤੇ ਮੇਰੇ ਘਰ ਦਾ ਪਤਾ ਹੈ ਨਿਊ ਦਿੱਲੀ ਮਾਡਲ ਸੱਤ

ਪਲੀਜ਼ ਜਲਦ ਤੋਂ ਜਲਦ ਗਲੈਸ ਗੈਸ ਸਿਲਿੰਡਰ ਦੀ ਬੁਕਿੰਗ ਕਰਕੇ ਪਲੀਜ ਗੈਸ ਸਿਲੰਡਰ ਨੂੰ ਡਿਲੀਵਰ ਕਰ ਦਿਉ